ਮੈਂ ਐਮਾਜੋਨ ਤੋਂ ਇੱਕ ਮੋਬਾਈਲ ਆਰਡਰ ਕੀਤਾ ਸੀ ਇਹ ਮੋਬਾਇਲ ਫੋਨ ਮੈਨੂੰ ਸਮੇਂ 'ਤੇ ਤਾਂ ਡਿਲੀਵਰ ਹੋ ਸਮੇਂ 'ਤੇ ਤਾਂ ਮਿਲ ਗਿਆ ਸੀ ਪਰ ਤੂੰ ਇਸਦਾ ਜੋ ਮੈਨੇ ਕੱਲ੍ਹ ਮੈਂ ਕਲਰ ਔਡਰ ਕੀਤਾ ਸੀ ਉਹ ਕਲਰ ਨਹੀਂ ਮਿਲਿਆ ਮੈਨੂੰ ਉਹਨਾਂ ਨੇ ਕਲਰ ਬਦਲ ਕੇ ਭੇਜ ਦਿੱਤਾ ਤਾਂ ਮੈਂ ਜਦੋਂ ਉਸੇ ਟਾਈਮ ਮੈਂ ਕਸਟਮਰ ਕੇਅਰ ਨੂੰ ਕਾਲ ਕੀਤਾ ਤਾਂ ਮੈਨੂੰ ਕਸਟਮਰ ਕੇਅਰਨੈਸ ਚੰਗੀ ਤਰ੍ਹਾਂ ਜਾਣਕਾਰੀ ਨਹੀਂ ਦਿੱਤੀ ਕਿ ਕਿਵੇਂ ਮੈਂ ਇਸ ਨੂੰ ਰਿਟਰਨ ਕਰ ਵਾਪਸ ਕਰ ਸਕਦਾ ਹਾਂ ਮੈਂ ਦੋ ਤਿੰਨ ਵਾਰ ਉਸ ਨੂੰ ਕਾਲ ਕੀਤਾ ਪਰੰਤੂ ਉਸਨੇ ਮੈਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਇਸ ਤੋਂ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਮੇਲ ਕੀਤੀ ਅਤੇ ਤਾਂ ਮੈਨੂੰ ਸਹੀ ਜਾਣਕਾਰੀ ਮਿਲੀ ਹੈ ਜਿਸ ਕਰਕੇ ਮੈਂ ਆਪਣਾ ਪਾਰਸਲ ਮੋਬਾਈਲ ਫੋਨ ਵਾਪਸ ਕਰਕੇ ਦੁਬਾਰਾ ਬਦਲ ਬਦਲ ਸਕਿਆ ਆਪਣਾ ਜਿਹੜਾ ਕਲਰ ਮੰਗਵਾਇਆ ਸੀ ਉਹ ਕਲਰ ਲੈ ਸਕਿਆ ਸੋ ਮੈਂ ਇਸ ਬਾਰੇ ਨੈਗਟਿਵ ਐਕਸਪੀਰੀਅਸ ਇਹ ਦੇਣਾ ਚਾਹੁੰਦਾ ਹਾਂ ਕਿ ਜਦੋਂ ਕਸਟਮਰ ਕੇਅਰ ਸਹੀ ਜਾਣਕਾਰੀ ਨਹੀਂ ਦੇ ਰਹੇ ਹਨ ਤਾਂ ਉਹਨਾਂ ਨੂੰ ਚਲਾਉਣ ਦਾ ਕੋਈ ਮਤਲਬ ਨਹੀਂ ਇਸ ਲਈ ਇਹ ਸੁਵਿਧਾ ਬੰਦ ਕੀਤੀ ਜਾਵੇ ਤਾਂ ਜਾਂ ਫਿਰ ਉਹਨਾਂ ਨੂੰ ਸਮਝਾਇਆ ਜਾਵੇ ਕਿ ਜੇ ਕੋਈ ਕਸਟਮਰ ਕੇਅਰ ਨੂੰ ਕਾਲ ਕਰਦਾ ਹੈ ਤਾਂ ਉਹਨੂੰ ਚੰਗੀ ਜਾਣਕਾਰੀ ਦਿੱਤੀ ਜਾਵੇ ਨਹੀਂ ਤਾਂ ਇਸ ਸੁਵਿਧਾ ਬੰਦ ਕਰ ਦਿੱਤੀ ਜਾਵੇ